ਆਮ ਖਾਸ ਬਾਗ ਸ਼ਹੀਦਾਂ ਦੀ ਧਰਤੀ ਸ਼੍ਰੀ ਫਤਿਹਗੜ ਸਾਹਿਬ ਅਤੇ ਆਲੇ ਦੁਆਲੇ ਖਾਸ ਕਰਕੇ ਸਰਹਿੰਦ ਸ਼ਹਿਰ ਦੇ ਨੇੜੇ ਬਣਿਆ ਹੋਇਆ ਹੈ ਆਮ ਖਾਸ ਬਾਗ ਮੁਗਲ ਰਾਜ ਸਮੇਂ ਦਾ ਬਾਗ ਹੈ ਇਸ ਨੂੰ ਬਾਬਰ ਨੇ ਬਣਵਾਇਆ ਸੀ ਅਤੇ ਸ਼ਾਹਜਹਾਨ ਨੇ ਇਸ ਨੂੰ ਦੁਬਾਰਾ ਤਿਆਰ ਕਰਵਾਇਆ ਸੀ ਤਾਂ ਜੋ ਕਿ ਸ਼ਾਹੀ ਰਾਜੇ ਉਹਨਾਂ ਦੇ ਪਰਿਵਾਰ ਦਿੱਲੀ ਤੋਂ ਲਾਹੌਰ ਆਉਂਦੇ ਜਾਂਦੇ ਸਮੇਂ ਇੱਥੇ ਠਹਿਰ ਸਕਣ ਆਮ ਖਾਸ ਬਾਗ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਸੀ ਇੱਕ ਹਿੱਸਾ ਆਮ ਲੋਕਾਂ ਲਈ ਰੱਖਿਆ ਗਿਆ ਸੀ ਅਤੇ ਦੂਜਾ ਹਿੱਸਾ ਰਾਜਿਆਂ ਲਈ ਰੱਖਿਆ ਗਿਆ ਸੀ ਇਸ ਕਰਕੇ ਇਸ ਦਾ ਨਾਮ ਆਮ ਖਾਸ ਬਾਗ ਪਿਆ ਅੱਜ ਕੱਲ੍ਹ ਲੋਕ ਆਮ ਖਾਸ ਬਾਗ ਵਿੱਚ ਘੁੰਮਣ ਫਿਰਨ ਲਈ ਜਾਂਦੇ ਹਨ ਆਮ ਖਾਸ ਬਾਗ ਹਰਿਆਲੀ ਨਾਲ ਭਰਿਆ ਹੋਇਆ ਇੱਕ ਬਾਗ ਹੈ ਜਿਸ ਵਿੱਚ ਕਈ ਪ੍ਰਕਾਰ ਦੇ ਫੁੱਲ ਬੂਟੇ ਲਗਾਏ ਗਏ ਹਨ ਜਿਸ ਵਿੱਚ ਕਈ ਪ੍ਰਕਾਰ ਦੇ ਫਲ ਫਰੂਟ ਵੀ ਲਗਾਏ ਹੋਏ ਹਨ ਇਸ ਬਾਗ ਵਿੱਚ ਵਾਤਾਵਰਨ ਇਕਦਮ ਸ਼ੁੱਧ ਹੁੰਦਾ ਹੈ ਅਤੇ ਇਸ ਵਿੱਚ ਇਸ ਬਾਗ ਵਿੱਚ ਘੁੰਮਣ ਲਈ ਕਈ ਹੀ ਜਗ੍ਹਾ ਬਣਾਈਆਂ ਗਈਆਂ ਹਨ ਆਪ ਖਾਸ ਬਾਗ ਇੱਕ ਵਿਸ਼ੇਸ਼ ਬਾਗ ਹੈ ਜਿਸ ਵਿੱਚ ਹਰੇਕ ਤਰ੍ਹਾਂ ਦੇ ਲੋਕ ਘੁੰਮਣ ਫਿਰਨ ਲਈ ਆਉਂਦੇ ਹਨ